ਭੰਗੜੇ ਦੇ ਸਟੈਪ ਬਾਹਾਂ ਨੂੰ ਖੋਲ੍ਹ ਕੇ ਲੱਤਾਂ ਨੂੰ ਖੋਲ੍ਹ ਕੇ ਉੱਪਰ ਵੱਲ ਉਛਾਲ ਕੇ ਅਤੇ ਹਲਕੀ ਜਿਹੀ ਫੇਸ ਉੱਪਰ ਸਮਾਈਲ ਰੱਖਣੀ ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ ਦੂਜਾ ਮੁੱਖ ਨਾਚ ਗਿੱਧਾ ਹੈ ਭੰਗੜਾ ਗੱਭਰੂਆਂ ਦਾ ਨਾਚ ਹੈ ਜਦ ਕਿ ਗਿੱਧਾ ਮੁਟਿਆਰਾਂ ਦਾ ਭੰਗੜਾ ਤਰਤੀਬ ਹਰ ਖੁਸ਼ੀ ਦੇ ਮੌਕੇ ਦੇ ਪਾਇਆ ਜਾਂਦਾ ਹੈ ਜਿਹਨਾਂ ਵਿੱਚ ਕਣਕ ਦੀ ਵੱਢੀ ਹੋਈ ਵਿਸਾਖੀ ਵਾਲੇ ਮੇਲੇ ਵਿਆਹ ਮੰਗਣੇ ਅਤੇ ਹੋਰ ਤਿਉਹਾਰਾਂ 'ਤੇ ਵੀ ਸ਼ਾਮਿਲ ਹੁੰਦਾ ਹੈ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿਹਨਾਂ ਦੀ ਹੀ ਪਹਿਚਾਣ ਹੈ ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਦੇ ਸੁਨਹਿਰੇ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਦਾ ਮਨ ਲੁਹਾਰ ਵਿੱਚ ਆ ਕੇ ਨੱਚ ਖਲੋਤਾ ਲੰਘੇ ਕਾਧੜਾ ਦੇ ਕਗੜੀ ਮਿਹਨਤ ਨਾਲ ਸੁਨਹਿਰਾ ਫਲ ਲੱਗਿਆ ਦੇਖ ਕਿ ਕਿਸ ਦਾ ਨਹੀਂ ਨੱਚ ਉੱਠਦਾ ਮੁੱਠ ਵਿੱਚ ਇਹ ਨਾਚ ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਨੱਚਿਆ ਜਾਂਦਾ ਹੈ